ਮੈਂ ਮੈਂ ਟੀ ਵੀ ਦੇਖਣਾ ਬਿਲਕੁਲ ਵੀ ਪਸੰਦ ਨਹੀਂ ਕਰਦੀ ਹਾਂ ਪਰੰਤੂ ਫਿਰ ਵੀ ਮੈਂ ਫੋਨ 'ਤੇ ਇੰਟਰਨੈਟ ਚਲਾਉਂਦੀ ਹਾਂ ਅਤੇ ਇੰਟਰਨੈਟ 'ਤੇ ਅਤੇ ਫੋਨ 'ਤੇ ਹੀ ਇੰਸਟਾਗ੍ਰਾਮ ਰੀਲਸ ਅਤੇ ਟਿਕਟੋਕ ਰੀਲਸ ਦੇਖਣਾ ਪਸੰਦ ਕਰਦੀ ਹਾਂ